ਆਮ ਤੌਰ 'ਤੇ ਤਾਂ ਮੈਂ ਅਜੀਤ ਅਖ਼ਬਾਰ ਹੀ ਪੜ੍ਹਦਾ ਹਾਂ ਪਰ ਪਿਛਲੇ ਕੁਛ ਸਮੇਂ ਤੋਂ ਮੈਂ ਆਪਣੇ ਪੜ੍ਹਨ ਵਿੱਚ ਪੰਜਾਬੀ ਟ੍ਰਿਬਿਊਨ ਨੂੰ ਵੀ ਸ਼ਾਮਿਲ ਕੀਤਾ ਹੈ ਜੇਕਰ ਦੋਨਾਂ ਦੇ ਗੱਲ ਕੀਤੀ ਜਾਵੇ ਤਾਂ ਅਜੀਤ ਅਖ਼ਬਾਰ ਦੇ ਵਿੱਚ ਜ਼ਿਆਦਾਤਰ ਪੌਲੀਟੀਕਲ ਖਬਰਾਂ ਆਉਂਦੀਆਂ ਹਨ ਪਰ ਟ੍ਰਿਬਿਊਨ ਦੇ ਵਿੱਚ ਐਜੂਕੇਸ਼ਨਲ ਖਬਰਾਂ ਉੱਤੇ ਜ਼ਿਆਦਾ ਧਿਆਨ ਦਿੰਦਾ ਹੈ ਅਜੀਤ ਅਖ਼ਬਾਰ ਦੇ ਵਿੱਚ ਜ਼ਿਆਦਾਤਰ ਲੌਕਲ ਆਏਰੀਆ ਦੀਆਂ ਖਬਰਾਂ ਅਤੇ ਸਮੱਸਿਆਵਾਂ ਦੀਆਂ ਖਬਰਾਂ ਹੀ ਖਬਰਾਂ ਆਉਂਦੀਆਂ ਹਨ ਪਰ ਪੰਜਾਬੀ ਟ੍ਰਿਬਿਊਨ ਦੇਸ਼ ਵਿਦੇਸ਼ ਦੀਆਂ ਜ਼ਿਆਦਾ ਖਬਰਾਂ ਨੂੰ ਕਵਰ ਕਰਦਾ ਹੈ